ਤਾਰਿਆਂ ਦੀ ਕਹਾਣੀਆਂ ਅਸੀਂ ਬਚਪਨ ਤੋਂ ਸੁਣਦੇ ਆ ਰਹੇ ਹਾਂ ਸਾਡੀ ਨਾਨੀ ਦਾਦੀ ਬਹੁਤ ਕੁਝ ਸੁਣਾਉਂਦੀ ਸੀ ਤਾਰਿਆਂ ਬਾਰੇ ਅਤੇ ਜਦ ਅਸੀਂ ਦਸਵੀਂ ਚ ਹੋਏ ਤਾਂ ਸਾਨੂੰ ਵਿਗਿਆਨ ਵਿੱਚ ਕਈ ਇੱਦਾਂ ਦੇ ਪਾਠ ਸੀਗੇ ਜਿਹਦੇ ਵਿੱਚ ਤਾਰਿਆਂ ਬਾਰੇ ਪੜ੍ਹਾਇਆ ਜਾਂਦਾ ਸੀਗਾ ਜਿੱਦਾਂ ਸੌਰ ਮੰਡਲ 'ਚ ਗਲੈਕਸੀ ਕਿੰਨੇ ਤਾਰਿਆਂ ਨਾਲ਼ ਗਲੈਕਸੀ ਬਣਦੀ ਹੈ ਅਤੇ ਇੱਕ ਧਰੁਵ ਤਾਰਾ ਹੁੰਦਾ ਹੈ ਜਿਹੜਾ ਚੰਦਰਮਾ ਦੇ ਆਲ਼ੇ ਦੁਆਲ਼ੇ ਘੁੰਮਦਾ ਆ ਅਤੇ ਤਾਰਿਆਂ ਬਾਰੇ ਮੈਨੂੰ ਜਾਣੀ ਗੱਲ ਕਰਨ ਅਤੇ ਉਹਦੇ ਬਾਰੇ ਨੌਲੇਜ ਰੱਖਣੀ ਬਹੁਤ ਹੀ ਅੱਛੀ ਲੱਗਦੀ ਹੈ